ਮੇਰੀਆਂ ਸ਼ਕਤੀਆਂ ਇਹ ਹਨ ਕਿ ਮੇਰਾ ਪਰਿਵਾਰ ਸਹੀ ਕੰਮ ਲਈ ਹਰ ਵੇਲੇ ਮੇਰੇ ਨਾਲ਼ ਖੜਾ ਹੁੰਦਾ ਹੈ ਅਤੇ ਮੈਨੂੰ ਮੋਟੀਵੇਟ ਕਰਦਾ ਹੈ ਅਤੇ ਮੇਰੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ਇਹ ਹਨ ਕਿ ਮੈਨੂੰ ਗੁੱਸਾ ਬਹੁਤ ਛੇਤੀ ਆ ਜਾਂਦਾ ਹੈ ਕਿਉਂਕਿ ਜੇ ਕੋਈ ਸਾਹਮਣੇ ਗਲਤ ਕੰਮ ਕਰਦਾ ਹੋਵੇ ਤਾਂ ਉਹਨੂੰ ਦੇਖ ਕੇ ਮੈਨੂੰ ਗੁੱਸਾ ਛੇਤੀ ਆ ਜਾਂਦਾ ਹੈ